ਮੈਂ ਸ਼ਾਰਕ ਟੈਂਕ ਟੀ ਵੀ ਸ਼ੋ ਤੋਂ ਜਾਣੂ ਹਾਂ ਜੋ ਕਿ ਸੋਨੀ ਚੈਨਲ 'ਤੇ ਆਉਂਦਾ ਹੈ ਅਤੇ ਇਸ ਵਿੱਚ ਬਹੁਤ ਵੱਡੇ ਵੱਡੇ ਉਦਯੋਗਪਤੀ ਸ਼ਿਰਕਤ ਕਰਦੇ ਹਨ ਜਿਵੇਂ ਕਿ ਅਸ਼ਨੀਰ ਗਰੋਵਰ ਦੁਪਿੰਦਰ ਗੋਇਲ ਪਿਊਸ਼ ਬੰਸਲ ਬਨੀਤਾ ਸਿੰਘ ਅਤੇ ਹੋਰ ਵੀ ਬਹੁਤ ਵੱਡੇ ਵੱਡੇ ਉਦੋਗਪਤੀਆਂ ਦਾ ਨਾਂ ਹੈ ਇਸ ਵਿੱਚ ਉਹ ਆਪਣੇ ਆਪਣੇ ਪੈਸੇ ਲੋਕਾਂ ਨੂੰ ਦਿੰਦੇ ਹਨ ਕਿ ਤੁਸੀਂ ਬਿਜ਼ਨਸ ਵਿੱਚ ਲਗਾਓ ਅਤੇ ਆਪਣਾ ਕਾਰੋਬਾਰ ਹੋਰ ਵੀ ਵੱਡਾ ਕਰੋ ਅਤੇ ਉਹ ਕੁਝ ਕੁ ਹਿੱਸਾ ਲੈਂਦੇ ਹਨ ਪ੍ਰੋਫਿਟ ਦਾ ਯਾਨੀ ਕਿ ਜੋ ਵੀ ਉਹਨਾਂ ਨੂੰ ਮੁਨਾਫਾ ਹੁੰਦਾ ਹੈ ਉਸ ਦਾ ਕੁਝ ਕੁ ਹਿੱਸਾ ਉਹ ਲੈਂਦੇ ਹਨ ਅਤੇ ਬਾਕੀ ਉਹ ਜੋ ਵੀ ਉਹਨਾਂ ਦੀਆਂ ਇੱਛਾਵਾਂ ਹਨ ਵੀ ਕੁਝ ਕੁਝ ਲੋਕ ਹੁਣ ਜਿਵੇਂ ਕਹਿੰਦੇ ਹਨ ਕਿ ਸਾਡਾ ਜਿਹੜਾ ਪ੍ਰੋਡਕਟ ਅਸੀਂ ਬਣਾਇਆ ਹੈ ਉਹ ਪੂਰੇ ਭਾਰਤ ਦੇਸ਼ ਵਿੱਚ ਜਾਵੇ ਅਤੇ ਉਹ ਉਸ ਨੂੰ ਪੂਰੇ ਭਾਰਤ ਦੇਸ਼ ਵਿੱਚ ਲਿਜਾਣ ਵਾਸਤੇ ਮਦਦ ਕਰਦੇ ਹਨ ਅਤੇ ਕਿਉਂਕਿ ਉਹਨਾਂ ਦਾ ਜਿਹੜਾ ਨੈਟਵਰਕ ਹੈ ਉਹ ਜ਼ਿਆਦਾ ਵੱਡਾ ਹੈ ਅਤੇ ਇਸ ਕਰਕੇ ਲੋਕ ਸਾਰਕ ਟੈਂਕ ਵਿੱਚ ਜਾਂਦੇ ਹਨ ਵੀ ਆਪਣਾ ਕਾਰੋਬਾਰ ਹੋਰ ਵੀ ਵੱਧ ਸਕੇ ਅਤੇ ਜੇ ਇਹ ਕਾਰੋਬਾਰ ਸ਼ੁਰੂ ਕਰਨ ਵਾਲਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਤਾਂ ਜੋ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਇੱਛਾ ਪੈਦਾ ਹੁੰਦੀ ਹੈ ਕਿ ਅਸੀਂ ਵੀ ਕੋਈ ਕਾਰੋਬਾਰ ਸ਼ੁਰੂ ਕਰੀਏ ਅਤੇ ਅਸੀਂ ਵੀ ਸ਼ਾਰਕ ਟੈਂਕ ਦੇ ਵਿੱਚ ਜਾਈਏ ਅਤੇ ਸ਼ਾਰਕ ਟੈਂਕ ਦੇ ਵਿੱਚ ਜਾ ਕੇ ਅਸੀਂ ਵੀ ਉਹਨਾਂ ਤੋਂ ਇਨਵੈਸਟਮੈਂਟ ਪ੍ਰਾਪਤ ਕਰੀਏ ਅਤੇ ਆਪਣੇ ਜਿਹੜਾ ਵੀ ਪ੍ਰੋਡਕਟ ਹੈ ਜਾਂ ਕੋਈ ਵੀ ਸਰਵਿਸ ਹੈ ਉਸ ਨੂੰ ਪੂਰੇ ਭਾਰਤ ਦੇਸ਼ ਵਿੱਚ ਲਿਜਾਈਏ ਅਤੇ ਆਪਣਾ ਅਤੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰੀਏ ਧੰਨਵਾਦ ਜੀ